ਮੇਰੇ ਅਨੁਸਾਰ ਯੋਗਾ ਜਿਹੜੀ ਆ ਜੀ ਉਮਰ ਛੋਟੇ ਬਚਪਨ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਆ ਐਕਸਰਸਾਈਜ਼ ਛੋਟੀ ਛੋਟੀ ਛੋਟੇ ਬੱਚਿਆਂ ਨੂੰ ਕਰਵਾਉਣੀ ਚਾਹੀਦੀ ਹੈ ਥੋੜ੍ਹੀ ਥੋੜ੍ਹੀ ਉਹ ਤੋਂ ਬਾਅਦ ਦਸ ਬਾਰਾਂ ਸਾਲ ਦੀ ਉਮਰ ਤੋਂ ਬਾਅਦ ਯੋਗਾ ਜਿਹੜਾ ਆ ਸ਼ੁਰੂ ਕਰ ਲੈਣਾ ਚਾਹੀਦਾ ਉਹਨੂੰ ਇਹਦੇ ਨਾਲ ਫਾਇਦੇ ਕੀ ਆ ਵੀ ਸਾਡੀਆਂ ਜਿਹੜੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਬੱਚਿਆਂ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਉਹਨਾਂ ਨੂੰ ਦਵਾਈਆਂ ਦੀ ਲੋੜ ਨਹੀਂ ਪੈਂਦੀ ਉਹਨਾਂ ਦੀ ਸਾਹ ਪ੍ਰਕਿਰਿਆ ਜਾਂ ਫੇਫੜੇ ਗੁਰਦੇ ਆਦਿ ਜਿਹੜੇ ਉਹ ਸਹੀ ਤਰੀਕੇ ਨਾਲ ਕੰਮ ਕਰਦੇ ਰਹਿੰਦੇ ਆ ਜਿੱਥੋਂ ਤੱਕ ਹੋ ਸਕੇ ਬੰਦੇ ਨੂੰ ਸਾਰੀ ਉਮਰ ਹੀ ਲਾਸਟ ਦੀ ਉਮਰ ਤੱਕ ਵੀ ਯੋਗਾ ਕਰਦੇ ਰਹਿਣਾ ਚਾਹੀਦਾ ਉਹਨੂੰ ਆਪਣੀ ਜ਼ਿੰਦਗੀ 'ਚ ਕਦੀ ਉਹਦੇ ਪੀੜਾਂ ਦਰਦਾਂ ਦੀ ਮੁਸ਼ਕਿਲ ਨਹੀਂ ਆਊਗੀ ਕਦੀ ਵੀ ਉਹਨੂੰ ਕੋਈ ਜਿਹੜੀ ਮਾਰੂ ਬਿਮਾਰੀਆਂ ਵਾ ਜਿਵੇਂ ਕੋਈ ਵੱਡੀਆਂ ਬਿਮਾਰੀਆਂ ਜਿਹਨੂੰ ਕਹਿ ਦਿੰਦੇ ਕੈਂਸਰ ਵਗੈਰਾ ਦੀ ਜਾਂ ਕਿਸੇ ਨੂੰ ਹਾ ਹਾਰਟ ਦੀ ਪ੍ਰੋਬਲਮ ਆ ਬੀ ਪੀ ਦੀ ਪ੍ਰੋਬਲਮ ਆ ਸ਼ੂਗਰ ਦੀਆਂ ਪ੍ਰੋਬਲਮਾਂ ਉਹ ਨਹੀਂ ਹੁੰਦੀਆਂ ਯੋਗਾ ਕਰਨ ਦੇ ਵੈਸੇ ਫਾਇਦੇ ਬਹੁਤ ਆ ਇਹਦੇ ਨਾਲ ਬੰਦਾ ਸਾਰੀ ਉਮਰ ਤੰਦਰੁਸਤ ਰਹਿੰਦਾ ਰਹਿੰਦਾ ਵਾ ਨਾਲ ਉਹਨੂੰ ਜਿਹੜਾ ਵਾ ਲਚਕੀਲਾਪਣ ਰਹਿੰਦਾ ਸਰੀਰ ਦੇ ਵਿੱਚ ਸਰੀਰ ਉਹਦਾ ਐਕਟਿਵ ਰਹਿੰਦਾ ਵਾ ਜੇ ਉਹ ਬੰਦਾ ਚਾਹੇ ਚੰਗੀ ਤਰ੍ਹਾਂ ਸਿੱਖ ਕੇ ਅਤੇ ਇਹਦੇ ਤੋਂ ਆਪਣਾ ਰੁਜ਼ਗਾਰ ਵੀ ਚਲਾ ਸਕਦਾ ਉਹ ਦੂਜੇ ਲੋਕਾਂ ਨੂੰ ਯੋਗਾ ਸਿਖਾ ਕੇ ਅਤੇ ਆਪਣਾ ਜਿਹੜਾ ਇੱਕ ਚੰਗੀ ਆਮਦਨ ਦਾ ਸਾਧਨ ਵੀ ਬਣਾ ਸਕਦਾ